ਮੈਂ ਇੱਕ ਵਾਰੀ ਦਸਵੀਂ ਦੇ ਕਲਾਸ ਵਿੱਚ ਟਰਿੱਪ 'ਤੇ ਗਈ ਸੀ ਹਿਮਾਚਲ ਪ੍ਰਦੇਸ਼ ਉੱਥੇ ਅਤੇ ਮੈਂ ਉੱਥੇ ਮੈਨੂੰ ਇੱਕ ਮਤਵ ਪੱਥਰ ਮਿਲਿਆ ਸੀ ਬਹੁਤ ਸੋਹਣਾ ਸੀ ਮਤਲਬ ਸ਼ੇਪ ਉਹਦੀ ਬਹੁਤ ਡਿਫਰੈਂਟ ਤਰ੍ਹਾਂ ਦੀ ਸੀ ਮਤਲਬ ਅਲੱਗ ਸੀਗੀ ਹੋਰ ਪੱਥਰਾਂ 'ਤੇ ਅਤੇ ਉਹਦੇ ਵਿੱਚ ਸੱਤ ਤਰ੍ਹਾਂ ਦੇ ਕਲਰ ਸੀਗੇ ਉਹ ਬਹੁਤ ਹੀ ਮਤਲਬ ਮਤਲਬ ਬਹੁਤ ਹੀ ਕਮ ਦੇਖਣ ਨੂੰ ਮਿਲਦੇ ਹੈ ਅਤੇ ਮਤਲਵ ਮੈਂ ਇੱਕ ਵਾਰੀ ਇਹਨੂੰ ਮਤਲਬ ਫੇਸਬੁੱਕ 'ਤੇ ਪਾਇਆ ਸੀ ਅਤੇ ਸ ਮੈਨੂੰ ਇਹਦੇ ਇਹਨੂੰ ਮਤਲਬ ਇਹਦੇ ਲਈ ਪੰਜ ਹਜ਼ਾਰ ਰੁਪਏ ਦਿੱਤੇ ਸੀ ਤਾਂ ਫਿਰ ਮੈਂ ਨਹੀਂ ਦੇ ਮਤਲਬ ਮੈਂ ਵੇਚਣਾ ਨਹੀਂ ਚਾਹਦੀ ਸੀ ਮੈਂ ਇਹਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ ਮੈਨੂੰ ਦਸ ਸਾਲ ਹੋ ਗਏ ਇਹਨੂੰ ਰੱਖਦੇ ਹੋਏ ਫਿਰ ਮੈਨੂੰ ਮਤਲਬ ਮੈਂ ਵੇਚਣਾ ਹੀ ਨਹੀਂ ਸੀ ਉਹਨੂੰ ਅਤੇ ਫਿਰ ਮੈਂ ਇਹ ਆਪਣੇ ਕੋਲ ਰੱਖਿਆ ਹੋਇਆ ਬਹੁਤ ਸਾਂਭ ਕੇ ਰੱਖਿਆ ਹੋਇਆ ਅਤੇ ਮੈਂ ਆਪਣੀ ਸਹੇਲੀਆਂ ਨੂੰ ਵੀ ਦਿਖਾਇਆ ਹੋਇਆ ਹੈ ਕਿ ਮਤਲਬ ਕਿਤੇ ਮੇਰੇ ਕੋਲ ਬਹੁਤ ਵਧੀਆ ਮਤਲਬ ਇੱਕ ਪੱਥਰ ਹੈ ਅਤੇ ਉਹ ਬਹੁਤ ਹੀ ਸ਼ਾਈਨਿੰਗ ਕਰਦਾ ਹੈ ਅਤੇ ਸੱਤ ਤਰ੍ਹਾਂ ਦੇ ਹੈ ਤਾਂ ਉਹ ਵੀ ਬਹੁਤ ਖੁਸ਼ ਹੋਈਆ ਦੇਖ ਕੇ ਅਤੇ ਮੇਰੇ ਘਰਆਲੇ ਨੂੰ ਵੀ ਮਤਲਬ ਦਿਖਾਇਆ ਸੀ ਮਤਲਬ ਉਹ ਵੀ ਬਹੁਤ ਖੁਸ਼ ਹੋਏ ਦੇਖ ਕੇ